ਮੋਹਾਲੀ ਜ਼ਿਲ੍ਹਾ ਇੱਕ ਬਹੁਤ ਹੀ ਸਾਫ਼ ਸੁਥਰਾ ਜ਼ਿਲ੍ਹਾ ਹੈ ਕਿਉਂਕਿ ਇਸ ਵਿੱਚ ਸਾਫ਼ ਸਫਾਈ ਦੀ ਮੁੱਖ ਭੂਮਿਕਾ ਨਗਰ ਪਾਲਿਕਾ ਖੁਦ ਉਠਾਉਂਦੀ ਹੈ ਹਾਲ ਹੀ ਵਿੱਚ ਮਗ ਨਰੇਗਾ ਸਕੀਮ ਸਰਕਾਰ ਵੱਲੋਂ ਚਲਾਈ ਗਈ ਸੀ ਜਿਸ ਵਿੱਚ ਆਮ ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਆਪਣਾ ਯੋਗਦਾਨ ਪਾਇਆ ਕੁਝ ਲੋਕ ਅਜਿਹੇ ਵੀ ਸਨ ਜਿਨਾਂ ਨੇ ਇਸ ਵਿੱਚ ਕੋਈ ਵੀ ਯੋਗਦਾਨ ਨਹੀਂ ਪਾਇਆ ਪਰ ਇਸ ਦਾ ਇਸ ਸਕੀਮ ਉੱਤੇ ਕੁਝ ਬਹੁਤਾ ਜ਼ਿਆਦਾ ਅਸਰ ਨਹੀਂ ਪਿਆ ਕੁਝ ਲੋਕ ਤਾਂ ਇਸ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ ਅਤੇ ਆਪਣੇ ਘਰ ਦੀ ਸਾਫ਼ ਸਫਾਈ ਦੇ ਨਾਲ ਨਾਲ ਆਪਣੇ ਆਲੇ ਦੁਆਲੇ ਦੀ ਸਫਾਈ ਦਾ ਵੀ ਬਹੁਤ ਧਿਆਨ ਰੱਖਦੇ ਹਨ ਸਾਡੇ ਖੇਤਰ ਵਿੱਚ ਵਾਤਾਵਰਨ ਦੀ ਮੁੱਖ ਸਮੱਸਿਆ ਪ੍ਰਦੂਸ਼ਣ ਹੈ ਪਰ ਇਸ ਸਕੀਮ ਨਾਲ ਪ੍ਰਦੂਸ਼ਣ ਵਿੱਚ ਵੀ ਬਹੁਤ ਘਾਟਾ ਆਇਆ ਹੈ ਕੁਝ ਚੁਣੌਤੀਆਂ ਜ਼ਰੂਰ ਹਨ ਪਰ ਇਹਨਾਂ ਦਾ ਬਹੁਤਾ ਮਾੜਾ ਅਸਰ ਨਹੀਂ ਪੈਂਦਾ